ਸਾਡੇ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਦਿਲਚਸਪ ਮੀਨਿੰਗ ਕਿ ਪਹਿਲੂਆਂ ਕਹਾਣੀਆਂ ਹਨ ਜਿਵੇਂ ਕਿ ਮੈਂ ਗੱਲ ਕਰਦੀ ਹਾਂ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਆ ਜਿਹੜਾ ਕਿ ਸ਼ਹੀਦ ਭਗਤ ਸਿੰਘ ਨਗਰ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਜੀ 'ਤੇ ਰੱਖਿਆ ਗਿਆ ਹੈ ਇਹ ਇਹਨਾਂ ਦਾ ਪਿੰਡ ਨਵਾਂ ਸ਼ਹਿਰ ਦੇ ਕੋਲ ਖਟਕਟ ਕਲਾਂ ਏ ਖਟਖਟ ਕਲਾਂ 'ਤੇ ਲੋਕ ਬਹੁਤ ਜ਼ਿਆਦਾ ਦੂਰ ਦੂਰ ਤੋਂ ਪ ਸ਼ਹੀਦ ਭਗਤ ਸਿੰਘ ਨ ਸ਼ਹੀਦ ਭਗਤ ਸਿੰਘ ਦਾ ਨਗਰ ਦੇਖਣ ਆਉਂਦੇ ਹਨ ਉੱਥੋਂ ਦਾ ਮਿਊਜ਼ੀਅਮ ਬਹੁਤ ਸੋਹਣਾ ਉੱਥੋਂ ਦੇ ਜਿਹੜੇ ਫੁੱਲ ਬੂਟੇ ਰੱਖੇ ਹਨ ਬਹੁਤ ਹੀ ਜ਼ਿਆਦਾ ਸੋਹਣੇ ਲੋਕ ਬਹੁਤ ਜ਼ਿਆਦਾ ਲੋਕ ਬਹੁਤ ਦੂਰੋਂ ਦੂਰ ਤੋਂ ਉਹਨੂੰ ਦੇਖਣ ਆਉਂਦੇ ਹਨ ਅਤੇ ਦੇਖਿਆ ਜਾਵੇ ਤਾਂ ਇੱਕ ਮਧੂਬਨ ਪਾਰਕ ਵੀ ਜੋ ਘਰ ਦੇ ਨੇੜੇ ਹੀ ਹੈ ਸਾਡੇ ਉਹ ਵੀ ਬਹੁਤ ਹੀ ਵਧੀਆ ਏ ਉੱਥੋਂ ਦੇਖਿਆ ਜਾਵੇ ਉ ਉੱਥੇ ਸਵੇਰ ਟਾਈਮ ਵੀ ਬਹੁਤ ਜ਼ਿਆਦਾ ਮੋਰਨਿੰਗ ਟਾਈਮ ਜਦੋਂ ਸੈਰ ਕਰਦੇ ਹਨ ਤਾਂ ਕਈ ਲੋਕ ਉੱਥੇ ਸੰਗੀਤ ਵੀ ਸੰਗੀਤ ਦੇ ਪ੍ਰਬੰਧ ਹੈ ਤਾਂ ਉੱਥੇ ਆ ਕੇ ਸੰਗੀਤ ਵਜਾਉਂਦੇ ਹਨ ਅਤੇ ਜਿਵੇਂ ਹੀ ਸ਼ਾਮ ਹੁੰਦੀ ਹੈ ਤਾਂ ਉੱਥੇ ਫਿਰ ਸੰਗੀਤ ਬੱਚੇ ਵੀ ਉੱਥੇ ਖੇਡਣ ਆਉਂਦੇ ਹਨ ਅਤੇ ਸੰਗੀਤ ਵੱਜਦਾ ਜਿਸ ਨਾਲ਼ ਬਹੁਤ ਹੀ ਸ਼ਾਂਤੀ ਹੁੰਦੀ ਹੈ ਅਤੇ ਉੱਥੇ ਬਹੁਤ ਹੀ ਜ਼ਿਆਦਾ ਦਿਲ ਵੀ ਲੱਗ ਜਾਂਦਾ ਹੈ ਜਦੋਂ ਵੀ ਕਦੇ ਦਿਲ ਕਰਦਾ ਤਾਂ ਅਸੀਂ ਉੱਥੇ ਨਾ ਕਿਉਂਕਿ ਸਾਡੇ ਘਰ ਦੇ ਕੋਲ ਹੈ ਅਸੀਂ ਜਦੇ ਚਲੇ ਜਾਂਦੇ ਹਾਂ ਅਤੇ ਉੱਥੇ ਬੱਚਿਆਂ ਦੇ ਖੇਡਣ ਲਈ ਵੀ ਬਹੁਤ ਜ਼ਿਆਦਾ ਝੂਲੇ ਲੱਗੇ ਹੋਏ ਹਨ ਉੱਥੇ ਖੇਡਣ ਲਈ ਹੋਰ ਵੀ ਬਹੁਤ ਚੀਜ਼ਾਂ ਹਨ ਜਿਵੇਂ ਕਿ ਸਲਾਈਡਸ ਹੋ ਗਏ ਝੂਲੇ ਹਰੇਕ ਤਰ੍ਹਾਂ ਦੇ ਹਨ ਅਤੇ ਉੱਥੇ ਖਾਣ ਪੀਣ ਦਾ ਵੀ ਪ੍ਰਬੰਧ ਹੁੰਦਾ ਹੈ